ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਕੰਪਨੀ ਤੋਂ ਥੋੜੀ ਦੇਰ ਪਹਿਲਾਂ ਸਮਾਟਵੋਚ ਔਡਰ ਕੀਤੀ ਸੀਗੀ ਜਿਹੜੀ ਕਿ ਕਰੋਸਬੀਟ ਸੀਗੀ ਔਰ ਜਿਹੜੀ ਕਿ ਤੁਹਾਡੇ ਡਿਲ ਐਪ ਤੋਂ ਮੈਂ ਡਿਲ ਐਪ ਤੋਂ ਮੈਂ ਔਡਰ ਕੀਤਾ ਸੀਗਾ ਐਪ ਦਾ ਜਿਹੜੀ ਡਿਲੀਵਰੀ ਸੀਗੀ ਬਿਲਕੁੱਲ ਮੈਨੂੰ ਸਹੀ ਟਾਈਮ 'ਤੇ ਮਿਲ ਚੁੱਕੀ ਸੀ ਮੈਂ ਔਡਰ ਦੇ ਜਿਹੜੀ ਜੋ ਤੁਹਾਡੇ ਪੈਕਿੰਗ ਸੀਗੀ ਪੈਕਿੰਗ ਸੀਗੀ ਤੁਹਾਡੀ ਸੀਗੀ ਬਿਲਕੁੱਲ ਵਧੀਆ ਲੱਗੀ ਹੈ ਖੋਲ੍ਹਣ ਤੋਂ ਮੇਰਾ ਮਨ ਖੁਸ਼ ਹੋਇਆ ਅਤੇ ਤੁਹਾਡੀ ਜਿਹੜੀ ਵਾਚ ਕੁਆਲਿਟੀ ਹੈਗੀ ਹੈ ਮੈਂ ਉਹਦੇ ਬਾਰੇ ਕੁਛ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਤੁਹਾਡੀ ਜਿਹੜੀ ਕੰਪਨੀ ਦੀ ਵਾਚ ਹੈਗੀ ਹੈ ਇਹ ਮੈਨੂੰ ਕਾਫ਼ੀ ਅੱਛੀ ਲੱਗੀ ਹੈ ਜਿਹਦੀ ਜੋ ਜੋ ਏਦੇ ਸੈਸਰ ਵਗੈਰਾ ਨੇ ਉਹ ਕਾਫ਼ੀ ਅੱਛੇ ਲੱਗੇ ਹੈ ਮੈਂ ਇਸ ਇਹਦਾ ਜਿਹੜਾ ਸਟ੍ਰੈਪ ਹੈ ਇਹਦੀ ਜੋ ਵਾਚ ਦੀ ਕੁਆਲਟੀ ਹੈਗੀ ਹੈ ਉਹ ਕਾਫ਼ੀ ਅੱਛੀ ਹੈ ਡਿਸਪਲੇਅ ਵੀ ਕਾਫ਼ੀ ਇੰਮਪ੍ਰੇਸਿਵ ਹੈ ਅਤੇ ਜਿਹੜੇ ਇਹ ਸੀਗੇ ਇਹ 'ਤੇ ਫੰਕਸ਼ਨਿੰਗ ਹੈਗੀ ਹੈ ਉਹ ਮੈਂ ਚੈੱਕ ਕਰ ਚੁਕਾ ਅਤੇ ਇੱਕ ਹਫ਼ਤੇ ਤੋਂ ਯੂਜ਼ ਵੀ ਕਰ ਰਿਹਾ ਕੰਪਨੀ ਮੇਰੇ ਲਈ ਬੜੀ ਹੈਲਪ ਜੋ ਕੰਪਨੀ ਤੁਹਾਡੀ ਵਾਚ ਹੈਗੀ ਹੈ ਬਹੁਤ ਹੈਲਪਫੁੱਲ ਹੈ ਮੈਂ ਇਹਨੂੰ ਹਰ ਰੋਜ਼ ਡੇਲੀ ਡੇਲੀ ਯੂਜ਼ ਕਰ ਰਿਹਾ ਕ ਜਿਹੜੇ ਇਹਦੇ ਤੁਹਾਡੀ ਵਾਚ ਦੇ ਸੈਸਰ ਨੇ ਇਹ ਪਰੋਪਰ ਤਰੀਕੇ ਨਾਲ਼ ਕੰਮ ਰਹੇ ਹਨ ਜਿਹੜੇ ਮੇਰੇ ਫ਼ਿਜੀਕਲ ਹੈਲਥ ਤੋਂ ਮੈਨੂੰ ਕਾਫ਼ੀ ਜ਼ਿਆਦਾ ਇੰਮਪਰੂਵ ਕਰਨ 'ਚ ਹੈਲਪ ਕਰ ਰਹੇ ਹਾਂ ਤੁਹਾਡੀ ਜਿਹੜੀ ਵਾਚ ਹੈਗੀ ਆ ਇਹਦੇ ਵਿੱਚ ਕਾਫ਼ੀ ਜ਼ਿਆਦਾ ਸਪੋਟਸ ਮੌਡ ਨੇ ਤਕਰੀਬਨ ਮੈਂ ਹਰ ਰੋਜ਼ ਹੀ ਤੁਹਾਡੇ ਸਪੋਟਸ ਮੋਡ ਨਾਲ਼ ਹੀ ਜਾਂ ਜੋ ਜਿੰਮ ਵਗੈਰਾ ਜਾ ਰਿਹਾ ਜਾਂ ਰਿਹਾ ਹਾਂ ਰਨਿੰਗ ਜਾਂ ਵੋਕਿੰਗ ਜਾਂ ਸਕੀਪਿੰਗ ਵਗੈਰਾ ਕਰ ਰਿਹਾ ਤਾਂ ਉਹ ਬੜੀ ਅੱਛੇ ਤਰੀਕੇ ਨਾਲ਼ ਕਰ ਪਾ ਰਿਹਾ ਤੁਹਾਡੇ ਇਹਦੇ ਕੰਮ ਕੰਪਨੀ ਦੇ ਘੜੀ ਦੇ ਵਿੱਚ ਕਾਫ਼ੀ ਜ਼ਿਆਦਾ ਜਿਹੜੀ ਹੈਲਥ ਇਸ਼ੂ ਹੈਲਥ ਬਾਰੇ ਜੋ ਜਾਣਕਾਰੀਆਂ ਨੇ ਇਹ ਪਰੋਪਰ ਤਰੀਕੇ ਨਾਲ਼ ਮੈਨੂੰ ਦੇ ਰਹੇ ਹੈ ਅਤੇ ਬਿਲਕੁੱਲ ਸਹੀ ਅਤੇ ਐਕੋਰੇਟ ਤਰੀਕੇ ਨਾਲ਼ ਦੇ ਰਹੀ ਹੈ ਅਤੇ ਇਸ ਲਈ ਤੁਹਾਡੀ ਜਿਹੜੀ ਕੰਪਨੀ ਦੀ ਵਾਚ ਹੈ ਇਹ ਬਹੁਤ ਜ਼ਿਆਦਾ ਕਾਫ਼ੀ ਵਧੀਆ ਲੱਗੀ ਮੈਨੂੰ ਮੈਂ ਹਾਈਲੀ ਇਹਨੂੰ ਹਰ ਇੱਕ ਕਿਸੇ ਨੂੰ ਰਿਕਮੈਂਡ ਕਰੂਗਾ ਵਧੀਆ ਵਾਚ ਦੇਣ ਲਈ ਤੁਹਾਡਾ ਧੰਨਵਾਦ